ਪੰਜਾਬ ਵਿੱਚ ਬਹੁਤ ਤਰ੍ਹਾਂ ਦੇ ਉਦਯੋਗ ਅਤੇ ਆਰਥਿਕ ਸੈਕਟਰ ਹਨ ਜਿਨ੍ਹਾਂ ਵਿੱਚ ਸਰਕਾਰੀ ਵੀ ਹਨ ਅਤੇ ਪ੍ਰਾਈਵੀਟ ਪ੍ਰਾਈਵੇਟ ਵੀ ਹਨ ਵੱਡੇ ਵੀ ਹਨ ਅਤੇ ਛੋਟੇ ਵੀ ਹਨ ਜਿਨ੍ਹਾਂ ਨੇ ਪੰਜਾਬ ਦੇ ਆਰਥਿਕ ਵਿਕਾਸ ਨੂੰ ਉੱਚਾ ਚੁੱਕਣ ਲਈ ਆਪਣਾ ਯੋਗਦਾਨ ਪਾਇਆ ਹੈ ਇਹ ਉਦਯੋਗ ਜਿਵੇਂ ਟੈਕਨੋਲੋਜੀ ਖੇਤਰ ਨਿਰਮਾਣ ਖੇਤਰ ਸਿਹਤ ਖੇਤਰ ਸਿੱਖਿਆ ਖੇਤਰ ਆਦਿ ਹਨ